ਹਾਂ ਅਮਨ ਕਿੱਦਾਂ ਵਧੀਆ ਹੋਰ ਕੀ ਕਰਦੀ ਕੁਛ ਨਹੀਂ ਬਸ ਮੈਂ ਵੀ ਬੈਠੀ ਸੀ ਹਾਂ ਬੋਲ

ਅੱਛਾ ਕੋਲੇਜ ਕੋਲੇ ਤਾਂ ਹੈਗਾ ਆ ਉੱਥੇ ਵੀ ਬਟ ਉਹ ਮੁੰਡਿਆਂ ਦੇ ਆ ਗਰਲਸ ਦਾ ਹੈ ਨਹੀਂ ਗਾ ਉਹਨਾਂ ਨੇ ਪਿਛਲੀ ਸਾਈਡ ਨੂੰ ਹੈ ਤਾਂ ਹੈ ਪਰ ਉਹ ਸਿਰਫ਼ ਬੋਆਇਸ ਦਾ ਆ ਜੇ ਤੂੰ ਰਹਿਣਾ ਤਾਂ ਮਤਲਬ ਹੈਗੇ ਆ ਸ਼ਰਮਾ ਪੀ ਜੀ ਵੀ ਆ ਬਟ ਉੱਥੇ ਰੇਟਸ ਬਹੁਤ ਹਾਈ ਆ ਉਹਨਾ ਖਾਣ ਪੀਣ ਦਾ ਵੀ ਨਹੀਂ ਹੈਗਾ ਰੇਟਸ ਬਹੁਤ ਹਾਈ ਆ ਉਹਨਾਂ ਦੇ ਚਾਰ ਪੰਜ ਪੀ ਜੀ ਹੈਗੇ ਆ ਆਹੀ ਬਸ ਪੰਦਰ੍ਹਾਂ ਮਿੰਟ ਦਾ ਰਸਤਾ ਹੋਰ ਹੋਰ ਆਟੋ ਵੀ ਜਾਂਦੇ ਆ ਉੱਧਰ ਨੂੰ ਹਾਂ ਹਾਂ ਨਹੀਂ ਪੀ ਜੀ ਵੈਸੇ ਤਾਂ ਦੇਖ ਕੇ ਜਾ ਕੇ ਵਿਜ਼ਿਟ ਕਰਨਾ ਪੈਣਾ ਆ ਮੈਨੂੰ ਇੱਕ ਦਾ ਹੀ ਪਤਾ ਬਾਕੀ ਸ਼ਰਮਾ ਦਾ ਉਹਨਾਂ ਨੇ ਰੇਟਸ ਮਤਲਬ ਹੈ ਨਹੀਂ ਠੀਕ ਸੋਚ ਲਓ ਖੀਣ ਪੀਣ ਦਾ ਵੀ ਸਫਾਈ ਵੀ ਨਹੀਂ ਹੁੰਦੀ ਇੰਨੀ ਉਹਨਾਂ ਦੇ ਮਤਲਬ ਇੱਕ ਰੂਮ ਦਾ ਉਹ ਮੇਰੇ ਹਿਸਾਬ ਨਾਲ ਲੈਂਦੇ ਹੋਣੇ ਹਜ਼ਾਰ ਦੋ ਹਜ਼ਾਰ ਅੱਛਾ ਚੱਲ ਫਿਰ ਉਹਨਾਂ ਦੇ ਕੰਪੈਰੀਜ਼ਨ ਨਾਲ ਤਾਂ ਠੀਕ ਆ ਸ਼ਰਮਾ ਠੀਕ ਆ ਉਹਨਾਂ ਦੇ ਮਤਲਬ ਇੱਕ ਤਾਂ ਵੈਸੇ ਰੇਟਸ ਵੀ ਬਟ ਖਾਣ ਪੀਣ ਦਾ ਨਹੀਂ ਮੈਨੂੰ ਇੰਨਾ ਪਤਾ

ਹਾਂ ਪਾਪਾ ਦੇ ਨੋਨ 'ਚ ਆ ਪੁੱਛ ਲਊਂਗੀ ਮੈਂ ਪਾਪਾ ਨੂੰ ਇੱਕ ਵਾਰ ਹਾਂ ਪੁੱਛ ਲਊਂਗੀ ਮੈਂ ਪਾਪਾ ਨੂੰ ਤੈਨੂੰ ਨੰਬਰ ਵੀ ਭੇਜ ਦਊਂਗੀ ਇੱਕ ਵਾਰ ਤੂੰ ਵੀ ਇਹਨਾਂ ਤੋਂ ਕਲੀਅਰ ਕਰ ਲਈਂ ਵਿੱਚ ਤਾਂ ਮੈਨੇਜ ਉੱਥੋਂ ਦੀ ਕੀ ਕਹਿੰਦੇ ਹੁੰਦੇ ਉਹਨੂੰ ਹੈਡ ਤਾਂ ਆਂਟੀ ਆ ਇੱਕ ਅੰਕਲ ਨਹੀਂ ਹੈਗੇ ਕਰ ਸਕਦੀ ਤੂੰ ਆਪਣੀ ਗੱਲ ਬਾਕੀ ਜੇ ਜਾਣਾ ਹੋਇਆ ਨਾ ਤਾਂ ਕੀ ਵਿਜ਼ਿਟ ਕਰ ਆਵਾਂਗੇ ਜੇ ਜਾਣਾ ਹੋਇਆ ਤਾਂ ਹਾਂ ਜਾ ਆਵਾਂਗੇ

ਹਾਂਜੀ ਖਾਣਾ ਪੂਰਾ ਵਿੱਚ ਹੀ ਹੈ ਹੋਰ ਕੀ ਕਰਦੀ ਅੱਜ ਕੱਲ੍ਹ ਹਾਂ ਫਿਰ ਤੂੰ ਰੋਜ਼ ਅਪ ਡਾਊਨ ਕਰਦੀ ਏਂ ਆਉਂਦੀ ਕਿੰਨੇ ਵਜੇ ਸਵੇਰੇ ਸ਼ਾਮ ਪੈ ਜਾਂਦੀ ਹੋਣੀ ਜਾਂਦੀ ਨੂੰ ਹੈ ਨਾ

ਪੀ ਜੀ ਤਾਂ ਹੈਗੇ ਆ ਕੋਲੇਜ ਤੋਂ ਦਸ ਪੰਦਰ੍ਹਾਂ ਮਿੰਟ ਦੇ ਰਸਤੇ ਬੜੀ ਹਦ ਵੀਹ ਵੀਹ ਕੁ ਮਿੰਟ ਦੇ ਹੋਣੇ ਆ ਰਸਤਾ ਬਟ ਇੱਕ ਆਰ ਸ਼ਰਮਾ ਦੀ ਮੈਨੂੰ ਪਤਾ ਸੀਗਾ ਬਾਕੀ ਜੇ ਮੈਂ ਪਤਾ ਕਰੂੰਗੀ ਜੇ ਹੋਏ ਤਾਂ

ਹਾਂ ਬੱਸਾਂ ਦਾ ਤਾਂ ਬਹੁਤ ਆ ਹਾਂ ਹੋਣੇ ਆ ਜਾ ਕੇ ਇੱਕ ਵਾਰ ਮੇਰੇ ਨਾਲ ਚੱਲ ਪਈਂ ਇੱਕ ਵਾਰ ਮੈਂ ਪਾਪਾ ਨੂੰ ਕਹੂੰਗੀ ਤੈਨੂੰ ਨੰਬਰ ਭੇਜ ਦੇਣਗੇ ਨਹੀਂ ਨਹੀਂ ਓਨਲੀ ਗਰਸਲ ਦਾ ਆ ਸ਼ਰਮਾ ਤਾਂ ਵਧੀਆ ਪੀ ਜੀ ਆ ਵੈਸੇ ਹਾਂ ਵਧੀਆ ਆ ਤੂੰ ਬਸ ਕੀ ਹੋਇਆ ਮੰਮਾ ਨੂੰ ਅੱਛਾ ਠੀਕ ਹੈ